ਪੰਜਾਬੀ ਪੁਸਤਕ ਪ੍ਰਕਾਸ਼ਨਾ ਵਿੱਚ ਨਵੇਂ ਨਵੇਂ ਤਜਰਬੇ ਹੁੰਦੇ ਰਹੇ ਹਨ ਅਤੇ ਹੋ ਰਹੇ ਹਨ ਕਈ ਪੁਸਤਕਾਂ ਵਿੱਚ ਇੱਕ ਇੱਕ ਰਚਨਾ ਨੂੰ ਤਿੰਨ ਤਿੰਨ ਲਿਪੀਆਂ ਵਿੱਚ ਵੀ ਦੇਖਿਆ ਗਿਆ ਹੈ ਅਤੇ ਦੋ ਲਿਪੀਆਂ ਵਿੱਚ ਤਾਂ ਅਕਸਰ ਕਿਤਾਬਾਂ ਛਪੀਆਂ ਮਿਲਦੀਆਂ ਹੀ ਹਨ ਧੰਨਵਾਦ